ਭਾਰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਵਿਅਕਤੀਆਂ ਲਈ ਸਾਡੇ ਪਿੰਡਾਂ ਦੇ ਵਿੱਚ ਆਮ ਜਦੋਂ ਦੇਖਣ ਸੁਣਨ ਨੂੰ ਮਿਲਦਾ ਤਾਂ ਪਹਿਲੀ ਗੱਲ ਇਹ ਹੁੰਦੀ ਹੈ ਕਿ ਵੀ ਮੰਨਿਆ ਜਾਂਦਾ ਪਿੰਡਾਂ ਦੇ ਵਿੱਚ ਕਿ ਜਿਹੜਾ ਤਾਂ ਬਹੁਤੀ ਚਿੰਤਾ ਕਰਦਾ ਤਾਂ ਉਹ ਉਹਦਾ ਭਾਰ ਨਹੀਂ ਵੱਧ ਸਕਦਾ ਚਿੰਤਾ ਮਨੁੱਖ ਦੇ ਭਾਰ ਨੂੰ ਘਟਾਉਂਦੀ ਆ ਵੈਸੇ ਜ਼ਿਆਦਾ ਜਿਹੜਾ ਘਰੇਲੂ ਉਪਚਾਰ ਇਹੀ ਆ ਕਿ ਖਾਣ ਪੀਣ ਖੁੱਲ੍ਹਾ ਹੋਵੇ ਦਹੀਂ ਮੱਖਣ ਲੱਸੀ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਖਾਣ ਵਾਲਾ ਹੋਵੇ ਬੰਦਾ ਫਿਰ ਉਹਦਾ ਭਾਰ ਵਧਣ ਦੀ ਜਿਹੜੀ ਆ ਬਹੁਤ ਜ਼ਿਆਦਾ ਸੰਭਾਵਨਾ ਵਾ ਅੱਜ ਸਾਡਾ ਖਾਣ ਪੀਣ ਜਿਹੜਾ ਉਸ ਤਰੀਕੇ ਦਾ ਨ ਨਹੀਂ ਰਿਹਾ ਜਿਵੇਂ ਦਾ ਆਮ ਪਿੰਡਾਂ ਦੇ ਵਿੱਚ ਹੁੰਦਾ ਸੀਗਾ ਪਿੰਡਾਂ ਦੇ ਵਿੱਚ ਹੁਣ ਘਰੇਲੂ ਉਪਚਾਰ ਇਹੀ ਆ ਕਿ ਖੁੱਲ੍ਹਾ ਖਾਣ ਪੀਣ ਹੋਵੇ ਦੁੱਧ ਦਹੀਂ ਮੱਖਣ ਘਿਓ ਖੁੱਲ੍ਹ ਕੇ ਬੰਦਾ ਖਾਵੇ ਅਤੇ ਇਸ ਦੇ ਨਾਲ ਨਾਲ ਜਿਹੜੀ ਬਣਦੀ ਉਹਦੀ ਕਸਰਤ ਆ ਜਿਹੜਾ ਸਰੀਰ ਨੂੰ ਮਿਹਨਤ ਦੇ ਨਾਲ ਜੋੜ ਕੇ ਰੱਖਣਾ ਇਸ ਤਰੀਕੇ ਦੇ ਨਾਲ ਇਹਨਾਂ ਸਾਰੀਆਂ ਗੱਲਾਂ ਦੇ ਨਾਲ ਜਿਹੜਾ ਭਾਰ ਵਧਾਉਣ ਦਾ ਜਿਹੜਾ ਇੱਕ ਵਧੀਆ ਘਰੇਲੂ ਉਪਚਾਰ ਆ ਉਹ ਪਿੰਡਾਂ ਦੇ ਵਿੱਚ ਅਪਣਾਇਆ ਜਾਂਦਾ ਖਾਸ ਕਰਕੇ ਇੱਕ ਤਾਂ ਬੇਲੋੜੀ ਚਿੰਤਾ ਨਹੀਂ ਲੈ ਕਰਨੀ ਦੂਸਰਾ ਖਾਣ ਪੀਣ ਦਾ ਜਿਹੜਾ ਉਹ ਧਿਆਨ ਰੱਖਣਾ ਅਤੇ ਇਸਦੇ ਨਾਲ ਮਨੁੱਖ ਆਪਣਾ ਭਾਰ ਵਧਾ ਸਕਦਾ ਇਹ ਆਮ ਪਿੰਡਾਂ ਦੇ ਵਿੱਚ ਜਿਹੜਾ ਘਰੇਲੂ ਉਪਚਾਰ ਜਿਹੜਾ ਸਾਨੂੰ ਸੁਣਨ ਨੂੰ ਦੇਖਣ ਨੂੰ ਮਿਲਦਾ